ਬਾਈਕਿੰਗ ਦੇ ਰਸਤੇ ਬਹੁਤ ਜ਼ਿਆਦਾ ਹਨ ਬਟ ਮੈਂ ਤੁਹਾਨੂੰ ਸਭ ਤੋਂ ਵੱਡਾ ਅਤੇ ਸਭ ਤੋਂ ਰੋਮਾਂਚਕ ਰਸਤਾ ਲੇਹ ਲਦਾਖ ਦਾ ਰਸਤਾ ਦੱਸਣਾ ਚਾਹੁੰਦਾ ਹਾਂ ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਅਤੇ ਐਡਵੈਂਚਰਰ ਰਸਤਾ ਹੈ ਜਿਸ ਦੇ ਲਈ ਪਹਿਲਾਂ ਸਾਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਐਂਟਰ ਕਰਨਾ ਪੈਂਦਾ ਹੈ ਹਿਮਾਚਲ ਤੋਂ ਬਾਅਦ ਅਸੀਂ ਉਸ ਤੋਂ ਬਾਅ ਹਿਮਾਚਲ ਤੋਂ ਬਾਅਦ ਅਸੀਂ ਹੋਰ ਅੱਗੇ ਹੌਲੀ ਹੌਲੀ ਜਾਂਦੇ ਹੋਏ ਸ੍ਰੀ ਦੁੰਗਲਾ ਪਾਸ ਤੱਕ ਪਹੁੰਚਦੇ ਹਨ ਉਸ ਤੋਂ ਬਾਅਦ ਜੋ ਰਸਤਾ ਹੈ ਬਹੁਤ ਜ਼ਿਆਦਾ ਖ਼ਤਰਨਾਕ ਹੋ ਜਾਂਦਾ ਹੈ ਅਤੇ ਇਸ ਦੇ ਵਿੱਚ ਕੀ ਆਉਂਦਾ ਹੈ ਸੜਕਾਂ ਵੀ ਅੱਧੀਆਂ ਕੱਚੀਆਂ ਹੁੰਦੀਆਂ ਹਨ ਲੈਂਡ ਸਲਾਈਡ ਵੀ ਬਥੇਰੀਆਂ ਹੁੰਦੀਆਂ ਹਨ ਅਤੇ ਰਸਤੇ ਕੋਈ ਅਤਾ ਪਤਾ ਨਹੀਂ ਹੁੰਦਾ ਕਿਉਂਕਿ ਉੱਥੇ ਗੂਗਲ ਮੈਪਸ ਵੀ ਨਹੀਂ ਚੱਲ ਪਾਉਂਦੇ ਇਸ ਦੇ ਕਾਰਨ ਕੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਡਰ ਲੱਗਿਆ ਰਹਿੰਦਾ ਹੈ ਕਿ ਅਸੀਂ ਮੰਜ਼ਿਲ ਕੰਨੀ ਪਹੁੰਚ ਵੀ ਪਾਵਾਂਗੇ ਕਿ ਨਹੀਂ ਬਟ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਜਜ਼ਬਾ ਬਹੁਤ ਜ਼ਿਆਦਾ ਹੈ ਤਾਂ ਕਰਕੇ ਇਸ ਕਰਕੇ ਉਹ ਦੱਬਦੇ ਨਹੀਂ ਅਤੇ ਉਹ ਚਲੀ ਹੀ ਜਾਂਦੇ ਜਾਂਦੇ ਹਨ ਅਤੇ ਅੱਜ ਦੇ ਘੜੀ ਦੇ ਵਿੱਚ ਬਹੁਤ ਜਨੇ ਜਨਿਆ ਨੇ ਯੂਟੀਊਬ ਦੇ ਉੱਤੇ ਵੀਡੀਓ ਪਾ ਪਾ ਕੇ ਰਸਤਾ ਵੀ ਲੱਭ ਕੇ ਦਿੱਤਾ ਰੇ ਹੋਇਆ ਹੈ ਜਿਸ ਦੇ ਰਾਹੀਂ ਮੈਂ ਵੀ ਇੱਕ ਦਿਨ ਆਪਣਾ ਸੁਪਨਾ ਪੂਰਾ ਕਰ ਕੇ ਬਾਈਕਿੰਗ ਦੇ ਨਾਲ ਉਹ ਰਸਤਾ ਐਕਸਪਲੋਰ ਕਰਾਂਗਾ ਅਤੇ ਅਤੇ ਮੈਂ ਵੀ ਆਪਣਾ ਇੱਕ ਯੂਟੀਊਬ ਚੈਨਲ ਸ਼ੁਰੂ ਕਰ ਕੇ ਉਸ 'ਤੇ ਆਪਣੀ ਹੀ ਆਪਣੀ ਜਰਨੀ ਦੀ ਇਹ ਵੀਡੀਓ ਪਾਵਾਂਗਾ ਅਤੇ ਇਸ ਦੇ ਨਾਲ ਕੀ ਹੈ ਹੋਰ ਵੀ ਰਸਤੇ ਹਨ ਇੱਕ ਮੇਰਾ ਹੋਰ ਚਾਉ ਹੈ ਕਿ ਮੈਂ ਰਾਜਸਥਾਨ ਵੀ ਸਾਰਾ ਆਪਣੀ ਮੋ ਬਾਈਕਿੰਗ ਦੇ ਨਾਲ ਹੀ ਕਵਰ ਕਰਾਂ ਉਸ ਦੇ ਵਿੱਚ ਕੀ ਹੈ ਜੈਸਲਮੇਰ ਦੇ ਵਿੱਚ ਜਿਹੜੇ ਰੇਤਾ ਇਹ ਮਿੱਟੀ ਦੇ ਟਿੱਬੇ ਹਨ ਉਹਨਾਂ 'ਤੇ ਵੀ ਆਪਣੀ ਮੋਟਰਸਾਈਕਲ ਚਲਾ ਕੇ ਆਪਣਾ ਸਪਨਾ ਪੂਰਾ ਕਰਾਂ ਅਤੇ ਹੋਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਵੀ ਇੱਕ ਵਾਰ ਮੈਂ ਟਰੈਵਲ ਕਰਨਾ ਚਾਹਾਂਗਾ ਆਪਣੀ ਮੋਟਰਸਾਈਕਲ 'ਤੇ ਜੋ ਕਿ ਇੱਕ ਤਿੰਨ ਦਿਨ ਦਾ ਸਫ਼ਰ ਹੋਊਗਾ ਜੇ ਆਪਾਂ ਲਗਾਤਾਰ ਚਲਾਈਏ ਮੋਟਰਸਾਈਕਲ ਨੂੰ ਬਟ ਇਹ ਹੋਣਾ ਨਹੀਂ ਹੈ ਇਸ ਕਰਕੇ ਅਸੀਂ ਪੂਰੀ ਰਜਾਮੰਦੀ ਤੇ ਅਤੇ ਸੂਝਬੂਝ ਦੇ ਨਾਲ ਮੈਂ ਉਹ ਸਫ਼ਰ ਪੂਰਾ ਕਰਾ ਅਤੇ ਮੈਂ ਆਪਣੇ ਚਾਰੋਂ ਬੁਰਜ ਜਿਹੜੇ ਉੜੀਸਾ ਦੇ ਵਿੱਚ ਹਨ ਉਹ ਵੀ ਉੱਥੇ ਜਾ ਕੇ ਐਕਸਪਲੋਰ ਕਰਾਂ ਅਤੇ ਹੌਲੀ ਹੌਲੀ ਸਾਰੀ ਦੁਨੀਆ ਵੀ ਐਕਸਪਲੋਰ ਕਰਾਂ ਅਤੇ ਮੇਰਾ ਇੱਕ ਸੁਪਨਾ ਹੈ ਕਿ ਮੈਂ ਯੂ ਕੇ ਯੂਨਾਈਟਿਡ ਕਿੰਗਡਮ ਮੈਂ ਆਪਣੀ ਮੋਟਰਸਾਈਕਲ 'ਤੇ ਜਾਵਾਂ ਜਿਵੇਂ ਇੱਕ ਬੰਦਾ ਅਨਮੋਲ ਜੈਸਵਾਲ ਜੋ ਆਪਣੀ ਸਕੋਰਪੀਓ ਐਨ ਗੱਡੀ ਦੇ ਵਿੱਚ ਪੂਰਾ ਵਰਲਡ ਟਰੈਵਲ ਕਰ ਰਿਹਾ ਹੈ ਉਸ ਤਰ੍ਹਾਂ ਕਿ ਮੈਂ ਵੀ ਇੱਕ ਵਰਲਡ ਟਰੈਵਲ ਕਰਾਂ ਅਤੇ ਆਪਣੀ ਮੈਂ ਜਰਮੀ ਜਰਨੀ ਵੀ ਵੀਡੀਓ ਉਸ ਦੇ ਉੱਤੇ ਪਾਵਾਂ ਅਤੇ ਹੌਲੀ ਹੌਲੀ ਆਪਣਾ ਮੈਂ ਕਰੀਅਰ ਬਣਾਵਾਂ ਇਸ ਦੇ ਚੀਜ਼ ਦੇ ਵਿੱਚ ਅਤੇ ਕਿਉਂਕਿ ਇਸ ਦੇ ਨਾਲ ਕੀ ਹੈ ਆਪਣੀ ਦੁਨੀਆ ਐਕਸਪਲੋਰ ਕਰਨ ਦੀ ਕ ਸ਼ਮਤਾਂ ਵੀ ਵੱਧਦੀ ਹੈ ਅਤੇ ਇਸ ਦੇ ਨਾਲ ਨਾਲ ਅਸੀਂ ਲਾਹੌਰ ਦੁਨੀਆਂ ਅਤੇ ਲ ਹੋਰ ਦੁਨੀਆਂ ਦੇ ਲੋਕਾਂ ਨੂੰ ਵੀ ਜਾਣਨਾ ਸ਼ੁਰੂ ਕਰ ਸਕਦੇ ਹਨ ਅਤੇ ਮੋਟਰਸਾਈਕਲ ਦੀ ਰੋ ਰਾਈਡਾਂ ਨੂੰ ਕੋਈ ਪਾਣੀ ਨਾ ਕੋਈ ਕੁਛ ਹੋਰ ਰੋਕ ਸਕਦਾ ਹੈ ਲੋਕ ਲੋਕਾਂ 'ਚ ਜਜ਼ਬਾ ਬੜਾ ਹੈ ਅਤੇ ਉਹ ਦੁਨੀਆਂ ਨੂੰ ਨਾਪਦੇ ਹੀ ਰਹਿਣਗੇ ਤੇ ਅਤੇ ਕਦੇ ਰੁਕਦੇ ਨਹੀਂ ਅਤੇ ਫ ਪਹਿਲਾਂ ਤਾਂ ਮੈਂ ਲੇਹ ਲਦਾਖ ਦਾ ਹੀ ਰਸਤਾ ਅਪਣਾਵਾਂਗਾ ਅਤੇ ਆਪਣੀ ਸ਼ੁਰੂਆਤ ਉੱਧਰੋਂ ਹੀ ਕਰਨਾ ਚਾਹਾਂਗਾ